ਹੈਲੋ ਹਾਂਜੀ ਮਿਸਿਜ਼ ਬੋਲਦੇ ਹੋ ਹਾਂਜੀ ਮੈਂ ਅਮਨ ਬੋਲ ਰਹੀ ਤੁਹਾਡੇ ਨਵੇਂ ਪੜੋਸੀ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਹੋ ਮੈਨੂੰ ਤੁਹਾਡੀ ਹੈਲਕ ਹੈਲਪ ਚਾਹੀਦੀ ਹਾਂਜੀ ਹਾਂਜੀ ਮੈਂ ਇੱਕ ਜਾਣਕਾਰੀ ਲੈਣੀ ਸੀਗੀ ਤੁਹਾਡੇ ਤੋਂ ਅਸੀਂ ਜਿਵੇਂ ਇੱਥੇ ਹੁਣ ਨਿਊ ਆਏ ਹਾਂ ਮੇਰੇ ਹਸਬੈਂਡ ਦਾ ਟਰਾਂਸਫਰ ਹੋਇਆ ਅਤੇ ਮੈਨੂੰ ਇੱਧਰਲੀ ਮਾਰਕੀਟ ਬਾਰੇ ਸ਼ੋਪਸ ਬਾਰੇ ਇੰਨੀ ਨੌਲੇਜ ਨਹੀਂ ਆ ਅਤੇ ਤੁਸੀਂ ਮੈਨੂੰ ਨਾਲੇਜ ਦਿਓ ਥੋੜ੍ਹੀ ਜਿਹੀ ਇਨਫੋਰਮੇਸ਼ਨ ਮੈਂ ਨਾ ਹੁਣ ਜਿਵੇਂ ਸਰਦੀਆਂ ਹਾਂਜੀ ਮੈਂ ਜਿਵੇਂ ਸਰਦੀਆਂ ਸ਼ੁਰੂ ਹੋਣ ਵਾਲੀਆਂ ਹੁਣ ਅਤੇ ਮੈਂ ਸਰਦੀਆਂ ਵਾਲੇ ਕੱਪੜੇ ਲੈਣੇ ਆ ਬੱਚਿਆਂ ਲਈ ਆਪਦੇ ਲਈ ਹਸਬੈਂਡ ਲਈ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਅਸੀਂ ਕਿੱਥੋਂ ਖਰੀਦ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਅੱਛਾ ਜੀ ਹਾਂਜੀ ਅੱਛਾ ਅੱਛਾ ਜੀ ਅੱਛਾ ਅੱਛਾ ਜੀ ਮੈਂ ਆਪਦੀ ਪਸੰਦ ਦੇ ਹਾਂਜੀ ਹਾਂਜੀ ਮੈਂ ਆਪਦੀ ਪਸੰਦ ਦਾ ਰੰਗ ਚੂਜ ਕਰਕੇ ਆਪਦੇ ਵੱਲੋਂ ਕੋਈ ਡਿਜ਼ਾਇਨ ਦੱਸਦੀ ਹਾਂ ਉਹ ਵੀ ਬਣਾ ਸਕਦੇ ਹੋ ਤੁਸੀਂ ਬਣਵਾ ਸਕਦੇ ਅੱਛਾ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਮੈਂ ਇੱਕ ਦੋ ਡਿਜਾਇਨ ਸਲੈਕਟ ਕੀਤੇ ਹੋਏ ਆਪਦੇ ਲਈ ਅਤੇ ਉਹ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਅਤੇ ਤੁਹਾਡੀ ਜਿਹੜੀ ਸ਼ੋਪ ਆਪਦੀ ਉੱਥੇ ਸ਼ਾਲ ਵੀ ਬਣਵਾਉਂਦੇ ਨੇ ਜਿਵੇਂ ਪਸ਼ਮ ਦੇ ਮੈਂ ਵੇਖੇ ਸੀ ਪਸ਼ਮ ਦੇ ਸ਼ਾਲ ਵੀ ਬਣਾਉਂਦੇ ਆ ਅੱਛਾ ਅੱਛਾ ਅਤੇ ਇਹਨਾਂ ਦੇ ਪ੍ਰਾਈਜ ਕੀ ਆ ਤੁਸੀਂ ਦੱਸ ਸਕਦੇ ਹੋ ਮੈਨੂੰ ਕੀ ਪ੍ਰਾਈਸ 'ਤੇ ਦਿੰਦੇ ਆ ਵੀ ਕਿਵੇਂ ਕੀ ਬਣਵਾਈ ਆ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਸਹੀ ਸਹੀ ਤੁਸੀਂ ਮੈਨੂੰ ਨਾ ਐਡਰੈਸ ਵਟਸਅੱਪ ਕਰ ਦਿਓ ਅਤੇ ਫਿਰ ਮੈਂ ਕੱਲ੍ਹ ਪਰਸੋਂ ਤੱਕ ਜਾਂ ਫਿਰ ਆਹ ਵੀਕ ਤੱਕ ਮੈਂ ਵਿਜਿਟ ਕਰ ਲੂੰਗੀ ਆਪਣੀ ਸ਼ੋਪ 'ਤੇ ਹਾਂ ਠੀਕ ਥੈਂਕ ਯੂ ਜੀ ਥੈਂਕ ਯੂ